ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਖਾਤਾ ਨੰਬਰ ਥ੍ਰੀ ਨਾਈਨ ਨਾਈਨ ਜ਼ੀਰੋ ਜ਼ੀਰੋ ਜ਼ੀਰੋ ਵੰਨ ਫੋਰ ਥ੍ਰੀ ਟੂ ਸਨ ਬੋਲਦਾ ਪਿਆ ਮੈਂ ਜਿਹੜੇ ਆਪਦੇ ਖਾਤੇ ਦਾ ਜਿਹੜਾ ਹੈਗਾ ਨੋਮੀਨੀ ਉਹ ਚੇਂਜ ਕਰਨਾ ਹੈਗਾ ਮੇਰੇ ਖਾਤੇ ਦੇ ਨੋਮੀਨੀ ਪਹਿਲਾਂ ਮੇਰੇ ਬ੍ਰਦਰ ਸੀਗੇ ਲੇਕਿਨ ਹੁਣ ਉਹਨਾਂ ਨੂੰ ਚੇਂਜ ਕਰਕੇ ਆਪਦੀ ਵਾਈਫ ਦਾ ਕਰਨਾ ਚਾਹੁੰਦਾ ਹੈਗਾ ਤਾਂ ਉਹਦੇ ਕਰਕੇ ਮੈਨੂੰ ਕੀ ਕੀ ਲੋੜ ਕੀ ਕੀ ਲੋੜ ਹੈ ਮੈਨੂੰ ਕੀ ਕਰਨਾ ਪਵੇਗਾ ਮੈਨੂੰ ਕੀ ਡਿਟੇਲ ਭਰਨੀ ਪਊਗੀ ਜਿਵੇਂ ਕਿਵੇਂ ਚੇਂਜ ਹੋਊਗਾ ਉਸ ਕਿਰਪਾ ਕਰਕੇ ਉਹ ਜਾਣਕਾਰੀ ਮੈਨੂੰ ਮੇਰੇ ਈਮੇਲ 'ਤੇ ਸੈਂਡ ਕੀਤੀ ਜਾਵੇ ਮੇਰਾ ਈਮੇਲ ਹੈ ਐਕਸ ਵਾਈ ਜ਼ੈੱਡ ਐਟ ਦ ਰੇਟ ਜੀਮੇਲ ਡੋਟ ਕੋਮ ਅਤੇ ਮੇਰਾ ਨੰਬਰ ਹੈ ਥ੍ਰੀ ਨਾਈਨ ਨਾਈਨ ਫੋਰ ਏਟ ਸੈਵਨ ਥ੍ਰੀ ਟੂ ਵੰਨ ਹੈ ਨਾ ਅਤੇ ਜੇ ਜੇ ਮੈਨੂੰ ਕਾਲ ਕਰਨਾ ਤਾਂ ਮੈਨੂੰ ਕਾਲ ਰਾਹੀਂ ਵੀ ਤੁਸੀਂ ਦੱਸ ਸਕਦੇ ਹੋ ਵੈਸੇ ਜੇ ਤੁਸੀਂ ਮੈਨੂੰ ਈਮੇਲ ਕਰੋਗੇ ਤਾਂ ਜ਼ਿਆਦਾ ਵਧੀਆ ਰਹੇਗਾ ਕਿਉਂਕਿ ਫਿਰ ਮੈਂ ਬਾਅਦ 'ਚ ਈਮੇਲ ਪੜ੍ਹ ਕੇ ਜੇ ਮੈਂ ਬਾਅਦ 'ਚ ਭੁੱਲ ਵੀ ਜਾਂਦਾ ਹਾਂ ਤਾਂ ਉੱਥੋਂ ਮੈਂ ਦੁਬਾਰਾ ਪੜ੍ਹ ਕੇ ਯਾਦ ਕਰ ਸਕਦਾ ਹਾਂ ਕਿ ਮੈਨੂੰ ਕੀ ਕੀ ਚਾਹੀਦਾ ਹੈ